ਰੂਪਨਗਰ ਜ਼ਿਲ੍ਹੇ ਵਿੱਚ ਮੁੱਖ ਸਿਹਤ ਸ ਸੰਭਾਲ ਸਹੂਲਤਾਂ ਜਿਵੇਂ ਕਿ ਸਿਵਲ ਹਸਪਤਾਲ ਰੂਪਨਗਰ ਵਿੱਚ ਬਣਿਆ ਹੋਇਆ ਹੈ ਉਹ ਵਧੀਆ ਕੰਮ ਕਰ ਰਿਹਾ ਹੈ ਇਸ ਤੋਂ ਇਲਾਵਾ ਰੋਪੜ ਵਿੱਚ ਪ੍ਰਾਈਵੇਟ ਹਸਪਤਾਲ ਵੀ ਬਹੁਤ ਹਨ ਜੋ ਕਿ ਵਧੀਆ ਕੰਮ ਕਰ ਰਹੇ ਹਨ ਅਗਰ ਕਿਸੇ ਨੂੰ ਫਿਰ ਵੀ ਜ਼ਿਆਦਾ ਗੰਭੀਰ ਬਿਮਾਰੀ ਹੋਵੇ ਤਾਂ ਪੀ ਜੀ ਆਈ ਚੰਡੀਗੜ੍ਹ ਵਿੱਚ ਜਾ ਕੇ ਉਸਦਾ ਇਲਾਜ ਹੋ ਜਾਂਦਾ ਹੈ ਅਤੇ ਬਾਕੀ ਕੋਵਿਡ ਮਹਾਂਮਾਰੀ ਦੇ ਦੌਰਾਨ ਜੋ ਵੀ ਜਿੰਨੇ ਵੀ ਹਸਪਤਾਲ ਰੋਪੜ ਵਿੱਚ ਸੀਗੇ ਉਹਨਾਂ ਨੇ ਸਾਰਿਆਂ ਨੇ ਵਧੀਆ ਕੰਮ ਕੀਤਾ ਹੈ ਅਤੇ ਬਹੁਤ ਹੀ ਘੱਟ ਇੱਥੇ ਮੌਤ ਦਰ ਰਹੀ ਹੈ ਬਾਕੀ ਸਾਰੇ ਪੰਜਾਬ ਨਾਲੋਂ ਅਤੇ ਪੂਰੇ ਭਾਰਤ ਨਾਲੋਂ ਲੋਕਾਂ ਨੇ ਵੀ ਆਪਸੀ ਸੂਝ ਬੂਝ ਨਾਲ ਸਾਰਾ ਕੰਮ ਲਿਆ ਹੈ